ਮੈਂ ਉਹਨਾਂ ਨਾਲ ਰਸੋਈ ਵਿੱਚ ਸਮਾਂ ਬਿਤਾਉਣ ਨੂੰ ਅਤੇ ਵਿਚਾਰ ਸਾਂਝਾ ਕਰਨ ਨੂੰ ਬਹੁਤ ਵਧੀਆ ਸਮਝਦੀ ਹਾਂ ਕਿਉਂਕਿ ਜਦੋਂ ਵੀ ਕੋਈ ਸਾਡੇ ਘਰ ਆਉਂਦਾ ਹੈ ਅਤੇ ਜਦੋਂ ਮੈਂ ਰਸੋਈ 'ਚ ਕੰਮ ਕਰਦੀ ਹਾਂ ਜੇਕਰ ਕੋਈ ਮੇਰੇ ਨਾਲ ਬੈਠ ਕੇ ਗੱਲਬਾਤ ਕਰਦਾ ਹੈ ਤਾਂ ਉਹਦੇ ਵਿੱਚ ਕੰਮ ਕਰਨ ਦਾ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਕੰਮ ਹੋ ਗਿਆ ਜਿਵੇਂ ਕਿ ਚਾਹ ਬਣਾਉਣਾ ਜਾਂ ਖਾਣਾ ਬਣਾਉਣਾ ਕੋਈ ਵੀ ਕੰਮ ਹੋਵੇ ਅਤੇ ਜੇਕਰ ਕੋਈ ਨਾਲ ਸਾਡੇ ਨਾਲ ਗੱਲਬਾਤ ਕਰਨ ਵਾਲਾ ਹੋਵੇ ਤਾਂ ਸਾਨੂੰ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਅਤੇ ਕੰਮ ਵੀ ਆਸਾਨੀ ਨਾਲ ਹੋ ਜਾਂਦਾ ਹੈ